ਭੰਗੜਾ ਐਰੋਬਿਸ ਅਸਲ ਵਿੱਚ ਕਈ ਤਰੀਕੇ ਨਾਲ ਮਾਨਸਿਕ ਸਿਹਤ ਅਤੇ ਭਾਵਨਾਤਮਕ ਤੰਦਰੁਸਤੀ 'ਚ ਯੋਗਦਾਨ ਪਾ ਸਕਦਾ ਹੈ ਜਿਵੇਂ ਕਿ ਇਹਦੇ 'ਚ ਹੁੰਦੀਆਂ ਭੰਗੜਾ ਐਰੋਬਿਕਸ ਇਸ ਵਿੱਚ ਊਰਜਾ ਗਤੀਵਿਧੀਆ ਸ਼ਾਮਿਲ ਹੁੰਦੀਆਂ ਜਿਹੜੇ ਆਪਣੇ ਹਾਰਮੋਨ ਜਾਰੀ ਕਰਦੇ ਹਨ ਨਿਯਮਿਤ ਕਸਰਤ ਜਿਵੇਂ ਕਿ ਆਪਣਾ ਭੰਗੜਾ ਐਰੋਬਿਕਸ ਹੋ ਗਿਆ ਇਹਨਾਂ ਚਿੰਤਾ ਅਤੇ ਉਦਾਸੀਆਂ ਨੂੰ ਘਟਾਉਣ ਵਿੱਚ ਮਦਦ ਕਰਦੀ ਆ ਸਮੁੱਚੀ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੀ ਆ ਅਤੇ ਦੂਜਾ ਇਹਦਾਂ ਸਮਾਜਿਕ ਸਬੰਧ ਵੀ ਹੈਗਾ ਵੀ ਕਿਸੇ ਸਮੂਹ ਜਾਂ ਜਿਵੇਂ ਕਿ ਆਪਣਾ ਕਲਾਸ ਵਿੱਚ ਨੱਚਣਾ ਅਤੇ ਸਮਾਜਿਕ ਗੱਲਬਾਤ ਅਤੇ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਭੰਗੜੇ ਐਰੋਬਿਕਸ ਲਈ ਦੂਜਿਆਂ ਨਾਲ ਜੁੜਨਾ ਇਹਦੇ 'ਚ ਇਕੱਲਾਪਣ ਦੀਆਂ ਭਾਵਨਾ ਨੂੰ ਦੂਰ ਕਰ ਸਕਦਾ ਅਤੇ ਤੁਹਾਡੇ ਮੂਡ ਨੂੰ ਸੁਧਾਰ ਸਕਦਾ ਅਤੇ ਤੀਜਾ ਇਹਦੇ ਤੋਂ ਹੁੰਦਾ ਬਈ ਆਪਣਾ ਮਨ ਅਤੇ ਸਰੀਰ ਦਾ ਤਾਲਮੇਲ ਅਤੇ ਇਹਨੂੰ ਸਿੱਖਣਾ ਇਹਦੇ 'ਚ ਹੁੰਦੀਆਂ ਹਰਕਤਾਂ ਦਾ ਤਾਲਮੇਲ ਕਰਨਾ ਮਨ ਅਤੇ ਸਰੀਰ ਦੋਵਾਂ ਨੂੰ ਸ਼ਾਮਿਲ ਕਰਦਾ ਹੈ ਇਹ ਨਕਾਰਮਾਤਕ ਵਿਚਾਰਾਂ ਤੋਂ ਧਿਆਨ ਭਟਕਾ ਸਕਦਾ ਹੈ ਅਤੇ ਮਾਨਸਿਕ ਸਪਸ਼ਟਤਾ ਨੂੰ ਵਧਾ ਸਕਦਾ ਹੈ ਅਤੇ ਚੌਥਾ ਇਹਦਾ ਹੈਗਾ ਬਈ ਇਹਦਾ ਸੱਭਿਆਚਾਰਿਕ ਸੰਬੰਧ ਵੀ ਹੈਗਾ ਕਿ ਸੱਭਿਆਚਾਰਿਕ ਗਤੀਵਿਧੀਆਂ ਵਿੱਚ ਇਹ ਸ਼ਾਮਿਲ ਹੋਣਾ ਆਪਣੀ ਪਛਾਣ ਮਨ ਅਤੇ ਮਾਣ ਅਤੇ ਆਪਣੀ ਵਿਰਾਸਤ ਨਾਲ ਸੰਬੰਧਿਤ ਹੀ ਭਾਵਨਾ ਪ੍ਰਦਾਨ ਕਰ ਸਕਦਾ ਮਾਨਸਿਕ ਸਿਹਤ ਨੂੰ ਸਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਹਦੇ 'ਚ ਆਪਣੇ ਬਈ ਨਿਰੰਤਰਤਾ ਮਹੱਤਵਪੂਰਨ ਹੈ ਭੰਗੜਾ ਐਰੋਬਿਕਸ ਵਿੱਚ ਨਿਯਮਿਤ ਭਾਗੇਦਾਰੀ ਜਿਵੇਂ ਆਪਾਂ ਕਰਦੇ ਰਹਿਣਗੇ ਤਾਂ ਆਪਣੇ ਭਾਵਨਾਤਮਕ ਤੰਦਰੁਸਤੀ ਲਈ ਲੰਬੇ ਸਮੇਂ ਦਾ ਲਾਭ ਮਿਲੂਗਾ ਆਪਾਂ ਨੂੰ